ਹਾਂ ਮੈਂਨੂੰ ਡਾਂਸ ਦੀ ਸ਼ੈਲੀ ਸਿੱਖਣ ਦਾ ਅਤੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਂ ਜਦੋਂ ਆਪਣੇ ਪੜ੍ਹਾਈ ਦੇ ਦਿਨਾਂ ਦੇ ਵਿੱਚ ਆਪਣੀ ਡਿਗਰੀ ਕਰ ਰਿਹਾ ਸਾਂ ਉਸ ਸਮੇਂ ਇੱਕ ਕੌਂਪੀਟੀਸ਼ਨ ਆਯੋਜਿਤ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਹਰ ਇੱਕ ਵਿਅਕਤੀ ਨੇ ਆਪਣੀ ਆਪਣੀ ਕਲਾਕ੍ਰਿਤੀ ਦਿਖਾ ਕੇ ਜਿਹੜੀ ਹੈਗੀ ਉਹ ਆਪਣੀ ਕਲਾ ਨੂੰ ਪ੍ਰਦਰਸ਼ਨ ਕਰਦਾ ਹਾਂ ਸੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਪੰਜਾਬ ਦਾ ਇੱਕ ਗੱਭਰੂ ਜਵਾਨ ਹੋਣ ਦੇ ਨਾਮ 'ਤੇ ਹਾਂ ਉੱਤੇ ਤਾਂ ਮੈਂ ਸੋਚਿਆ ਵੀ ਮੈਨੂੰ ਵੀ ਭੰਗੜਾ ਕਰਨਾ ਚਾਹੀਦਾ ਹੈ ਤਾਂ ਸ਼ੁਰੂ ਤੋਂ ਮੇਰਾ ਸ਼ੌਂਕ ਸੀ ਵੀ ਮੈਂ ਭੰਗੜਾ ਜਿਹੜਾ ਡਾਂਸ ਦੀ ਸ਼ੈਲੀ ਨੂੰ ਸਿੱਖਾਂ ਅਤੇ ਲੋਕਾਂ ਦੇ ਸਾਹਮਣੇ ਜਿਹੜਾ ਪ੍ਰਦਰਸ਼ਨ ਕਰਾਂ ਤਾਂ ਉਸ ਦਿਨ ਯੂਥ ਫੈਸਟੀਵਲ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਉਸ ਦੇ ਵਿੱਚ ਮੈਨੂੰ ਭੰਗੜਾ ਡਾਂਸ ਸੀ ਜਿਹੜਾ ਉਸ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ ਸਾਡੀ ਟੀਮ ਨੇ ਮੈਂ ਅਸੀਂ ਡਾਂਸ ਕੀਤਾ ਭੰਗੜਾ ਪ੍ਰਦਰਸ਼ਿਤ ਕੀਤਾ ਤਾਂ ਮੈਨੂੰ ਉਸ ਨੂੰ ਸਿੱਖਣ 'ਤੇ ਲਗਭਗ ਵੀਹ ਤੋਂ ਪੱਚੀ ਦਿਨਾਂ ਦਾ ਸਮਾਂ ਲੱਗਿਆ ਜਿਸ ਦੇ ਵਿੱਚ ਮੈਂ ਸਿੱਖਣ ਤੋਂ ਬਾਅਦ ਮੈਂ ਅਤੇ ਮੇਰੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਸ ਭੰਗੜੇ ਨੂੰ ਕੀਤਾ ਅਤੇ ਇਸ ਤੋਂ ਬਾਅਦ ਸਾਡਾ ਜਿੱਦਾਂ ਹੀ ਯੂਥ ਫੈਸਟੀਵਲ ਪ੍ਰੋਗਰਾਮ ਦੇ ਵਿੱਚੋਂ ਅਸੀਂ ਵਿਜੇਤਾ ਘੋਸ਼ਿਤ ਕਰ ਦਿੱਤੇ ਗਏ ਤਾਂ ਜਿਹੜੀ ਸਾਡੀ ਟੀਮ ਸੀ ਉਸ ਨੂੰ ਅਗਲੇ ਲੈਵਲ ਦੇ ਉੱਤੇ ਜਿਹੜਾ ਇੱਕ ਯੂਨੀਵਰਸਿਟੀ ਦੇ ਵਿੱਚ ਭੇਜ ਦਿੱਤਾ ਗਿਆ ਅ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਾਨੂੰ ਭੇਜਿਆ ਗਿਆ ਤਾਂ ਉੱਥੇ ਸਾਡਾ ਜਿਹੜਾ ਭੰਗੜੇ ਦਾ ਪ੍ਰੋਗਰਾਮ ਜਿਹੜਾ ਕੋਂਪਟੀਸ਼ਨ ਕਰਵਾਇਆ ਗਿਆ ਉਸ ਦੇ ਵਿੱਚ ਅਸੀਂ ਭੰਗ ਪ੍ਰਦਰਸ਼ਿਤ ਕੀਤਾ ਅਤੇ ਅ ਉੱਥੋਂ ਵੀ ਜਿਹੜੀ ਸਾਡੀ ਟੀਮ ਸੀ ਉਹ ਦੂਜੇ ਨੰਬਰ ਦੇ ਉੱਤੇ ਆਈ ਅਤੇ ਜਿਸ ਦੇ ਨਾਲ ਅਸੀਂ ਬਹੁਤ ਖੁਸ਼ ਸੀ ਅ ਅਸੀਂ ਭੰਗੜਾ ਕਰਕੇ ਬਹੁਤ ਖੁਸ਼ ਹਾਂ ਅਤੇ ਸਾਡੇ ਕਾਲਜ ਦਾ ਨਾਮ ਉੱਚਾ ਹੋਇਆ